ਸਤਿ ਸ਼੍ਰੀ ਅਕਾਲ ਜੀ ਸਰ ਹੋਮ ਲੈਣਾ ਸੀ ਤੁਸੀਂ ਤੁਸੀਂ ਮੋਹਾਲੀ ਤੋਂ ਬੋਲਦੇ ਹੋ ਜੀ ਅੱਛਾ ਜੀ ਸਰ ਥਰੀ ਬੀ ਐਚ ਕੇ ਹੋਮ ਲੈਣਾ ਸੀ ਕੀ ਪ੍ਰਾਈਸ ਪਰੂਸ ਆ ਆਪਣੇ ਅੱਛਾ ਜੀ ਜੇ ਮਤਲਬ ਆਪਾਂ ਲੋਕੇਸ਼ ਆਪਾਂ ਲ਼ ਕਲੋਨੀ ਜਿਹੜੀ ਲੈਣੀ ਹੈ ਜੀ ਹੈ ਨਾ ਪਿੱਛੇ ਹੱਟ ਕੇ ਲੈਣੀ ਹੈ ਮੇਨ ਰੋਡ ਤੇ ਜਿੱਥੇ ਨੋਇਸ ਨੁਇਸ ਘੱਟ ਆਵੇ ਤੇ ਵਰ੍ਤਕ੍ ਵਾਤਾਵਰਨ ਵਧੀਆ ਹੋਵੇ ਕਿਉਂਕਿ ਬੱਚੇ ਆ ਨਾਲ਼ ਬੱਚੇ ਹੈ ਜੀ ਫੈਮਲੀ ਆ ਫਿਰ ਉਹ ਪੜ੍ਹਨ ਵਾਸ ਵਾਸਤੇ ਔਖਾ ਹੁੰਦਾ ਜੀ ਅਸੀਂ ਫਲੈਟ ਟਾਈਪ ਚਾਹੀਦਾ ਫਲੈਟ ਟਾਈਪ ਸਾਨੂੰ ਫਲੈਟ ਟਾਈਪ ਚਾਹੀਦਾ ਜੀ ਹਾਂਜੀ ਅੱਛਾ ਜੀ ਅਤੇ ਆਪਾਂ ਨੂੰ ਫੈਸੀਲਟੀ ਕੀ ਕੀ ਮਿਲੇਗੀ ਜੀ ਇਹਦੇ 'ਚ ਆਪਣੇ ਅ ਅ

ਅਤੇ ਆਪਣਾ ਜਿਹੜੀ ਵਾਟਰ ਸਪਲਾਈ ਠੀਕ ਹੈ ਜੀ ਉੱਥੇ ਵਧੀਆ ਅੱਛਾ ਅਤੇ ਆਪਣੀ ਅੱਛਾ ਜੀ ਅਤੇ ਆਪਣੀ ਜਿਹੜੀ ਬਿਜਲੀ ਹੈ ਇਹ 'ਚ ਟਵੰਟੀ ਫੋਰ ਆਰਸ ਹੈ ਜਾਂ ਘੱਟ ਅੱਛਾ ਜੀ ਅਤੇ ਆਪਣੀ ਕਿ ਮਤਲਬ ਪ੍ਰਾਈਸ ਪਰੂਇਸ ਦੱਸ ਦਿੰਦੇ ਕੀ ਹੈ ਜੀ ਕੀ ਹਿਸਾਬ ਹੈ ਆਪਣੇ ਮਤਲਬ ਥੋੜ੍ਹਾ ਬਹੁਤਾ ਤਾਂ

ਅੱਛਾ ਜੀ ਚਲੋ ਫਿਰ ਤੁਸੀਂ ਇਵੇਂ ਕਰੋ ਸਾਨੂੰ ਆਪਣੀ ਲੋਕੇਸ਼ਨ ਅਤੇ ਆਪਣਾ ਨੰਬਰ ਸੈਂਡ ਕਰ ਦਿਓ ਫਿਰ ਅਸੀਂ ਤੁਹਾਨੂੰ ਮਿਲ ਲਾਂਗੇ ਸਰ ਓਕੇ ਸਰ ਥੈਂਕ ਯੂ